ਪੰਜਾਬੀ ਮੇਰੀ ਮਾਂ ਭਾਸ਼ਾ ਹੈ ਜੀ ਜਦੋਂ ਅਸੀਂ ਮੈਂ ਪੈਦਾ ਹੋਈ ਮੈਂ ਆਪਣੀ ਮੰਮੀ ਨੂੰ ਪੰਜਾਬੀ 'ਚ ਹੀ ਗੱਲ ਕਰਦੇ ਹੋਏ ਦੇਖਿਆ ਹਮੇਸ਼ਾ ਹੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਮੇਰੀ ਮੰਮੀ ਨੇ ਸਾਨੂੰ ਪੰਜਾਬੀ 'ਚ ਹੀ ਕਹਾਣੀਆਂ ਸੁਣਾਈਆਂ ਪੰਜਾਬੀ 'ਚ ਹੀ ਅਸੀਂ ਆਪਣੇ ਘਰਦਿਆਂ ਨਾਲ ਵਿਚਰਦੇ ਰਹੇ ਫਿਰ ਹੌਲੀ ਹੌਲੀ ਸਾਨੂੰ ਜਦੋਂ ਤੋਤਲੀ ਅਵਾਜ਼ 'ਚ ਬੋਲਦੇ ਸੀਗੇ ਪੰਜਾਬੀ 'ਚ ਹੀ ਬੋਲਦੇ ਸੀਗੇ ਫਿਰ ਹੌਲੀ ਹੌਲੀ ਸਾਨੂੰ ਪੰਜਾਬੀ ਐਨੀ ਜ਼ਿਆਦਾ ਸਾਰਿਆਂ ਤੋਂ ਸਾਡੇ ਜਿਹੜੇ ਘਰ ਦੇ ਸੀਗੇ ਮੇਰੇ ਦਾਦਾ ਜੀ ਦਾਦੀ ਜੀ ਮੰਮੀ ਪਾਪਾ ਸਾਰੇ ਪੰਜਾਬੀ 'ਚ ਹੀ ਗੱਲ ਕਰਦੇ ਸੀਗੇ ਤਾਂ ਜਿਹੜੀ ਮੁੱਢਲੀ ਜਿਹੜੀ ਸਾਨੂੰ ਪੰਜਾਬੀ ਬੋਲਣੀ ਆ ਉਹ ਤਾਂ ਸਾਨੂੰ ਮੇਰੀ ਮੰਮੀ ਤੋਂ ਹੀ ਸਿੱਖ ਗਏ ਸਾਡੀ ਫੈਮਿਲੀ ਦੇ ਵਿੱਚ ਸਾਰੇ ਬੋਲਦੇ ਸੀਗੇ ਤਾਂ ਪੰਜਾਬੀ ਉਹਨਾਂ ਤੋਂ ਹੀ ਸਿੱਖ ਗਏ ਤਾਂ ਉਹ ਜਿਹੜੇ ਲਿਖਣਾ ਸੀਗਾ ਕਿਵੇਂ ਲਿਖਦੇ ਨੇ ਕਿੱਥੇ ਤੋਂ ਸਟਾਰਟ ਹੁੰਦੀ ਆ ਉਹ ਫਿਰ ਸਾਨੂੰ ਸਕੂਲ ਦੇ ਵਿੱਚ ਜਦੋਂ ਐਡਮਿਸ਼ਨ ਹੋਈ ਸਾਡੀ ਮੇਰੀ ਮੰਮੀ ਨੇ ਸਾਨੂੰ ਪਹਿਲਾਂ ਆਂਗਣਵਾੜੀ ਦੇ ਵਿੱਚ ਸਾਨੂੰ ਪੜ੍ਹਨੇ ਪਾ ਤਾ ਫਿਰ ਪੰਜਾਬੀ ਉੱਥੇ ਅਸੀਂ ੳ ਅ ਸਿੱਖਦੇ ਰਹੇ ਸਾਨੂੰ ਬੈਠਣਾ ਸਿਖਾਇਆ ਪਹਿਲਾਂ ਤਾਂ ਉਹਨਾਂ ਨੇ ਫਿਰ ਸਾਨੂੰ ਉਹਨਾਂ ਨੇ ੳ ਅ ੲ ਹੈ ਨਾ ਇੱਦਾਂ ਕਰ ਕਰਕੇ ਸਾਨੂੰ ਉਹ ਸਿਖਾਇਆ ਫਿਰ ਸਾਨੂੰ ਐਲੀਮੈਂਟਰੀ ਸਕੂਲ ਦੇ ਵਿੱਚ ਭਰਤੀ ਕਰਤਾ ਫਿਰ ਉੱਥੇ ਅਸੀਂ ਪੂਰੀ ਤਰੀਕੇ ਨਾਲ ਵੀ ਜਿਵੇਂ ਟੀਚਰ ਸਾਨੂੰ ਦੱਸਦੇ ਸੀਗੇ ਕਿ ੳ ਏਦਾਂ ਏਦਾਂ ਪੈਂਦਾ ਆ ਹੈ ਨਾ ਸਾਨੂੰ ਲਿਖਣਾ ਸਿਖਾਇਆ ੳ ਅ ੲ ਸਾਰੀ ਗੁਰਮੁਖੀ ਲਿਪੀ ਸਾਨੂੰ ਸਿਖਾਈ ਹੈ ਨਾ ਕੰਨਾ ਫਿਰ ਸਿਹਾਰੀ ਬਿਹਾਰੀ ਫਿਰ ਬੋਲਣਾ ਸਿਖਾਇਆ ਫਿਰ ਅਸੀਂ ਹੈ ਨਾ ਹੌਲੀ ਹੌਲੀ ਕਰਦੇ ਕਰਦੇ ਫਿਰ ਜਿਉਂ ਜਿਉਂ ਸਾਡੀ ਉਮਰ ਵੱਧਦੀ ਗਈ ਹੈ ਨਾ ਕਿਤਾਬਾਂ ਨਾਲ ਪਿਆਰ ਪੈਂਦਾ ਗਿਆ ਉਸੇ ਤਰੀਕੇ ਨਾਲ ਫਿਰ ਅਸੀਂ ਇਹਨੂੰ ਹੈ ਨਾ ਚੰਗੀ ਤਰ੍ਹਾਂ ਲਿਖਣਾ ਸਿੱਖ ਲਿਆ ਫਿਰ ਉਸੇ ਤਰੀਕੇ ਨਾਲ ਜਦੋਂ ਪੜ੍ਹਦੇ ਸੀਗੇ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਪੰਜਾਬੀ ਸਕੂਲ 'ਚ ਪੜ੍ਹੇ ਹਾਂ ਤਾਂ ਸਾਰੇ ਸਬਜੈਕਟ ਸਾਡੇ ਪੰਜਾਬੀ 'ਚ ਹੁੰਦੇ ਸੀਗੇ ਤਾਂ ਹੌਲੀ ਹੌਲੀ ਅਸੀਂ ਕੀ ਕੀਤਾ ਕਿ ਇਹਨੂੰ ਸਿੱਖ ਲਿਆ ਚੰਗੇ ਤਰੀਕੇ ਨਾਲ ਹੁਣ ਅਸੀਂ ਮਤਲਬ ਐਨਾ ਜ਼ਿਆਦਾ ਪੰਜਾਬੀ ਦੇ ਨਾਲ ਮਤਲਬ ਅਸੀਂ ਸਾਨੂੰ ਐਨੀ ਵਧੀਆ ਲੱਗਦੀ ਹੈ ਪੰਜਾਬੀ ਬੋਲਣਾ ਪੰਜਾਬੀ 'ਚ ਗੱਲ ਕਰਨਾ ਪੰਜਾਬੀ ਲਿਖਣੀ ਬਹੁਤ ਵਧੀਆ ਲੱਗਦਾ ਆ ਪੰਜਾਬੀ